ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਬੋਲੋ ਜੀ ਕੌਣ ਬੋਲ ਰਹੇ ਹੋ ਜੀ ਹਾਂਜੀ ਹਾਂਜੀ ਬੋਲੋ ਜੀ ਜੀ ਜੀ ਜੀ ਬੋਲੋ ਜੀ ਕੀ ਚਾਹੀਦੀ ਹੈ ਜੀ ਅੱਛਾ ਜੀ ਜੀ ਜੀ ਹਾਂਜੀ ਇਹ ਜਿਹੜਾ ਨੰਬਰ ਦੀ ਆਹ ਰਜਿਸਟ੍ਰੇਸ਼ਨ ਹੋਣੀ ਆ ਨਾ ਜੀ ਇਹ ਹੋਣੀ ਹੈ ਡੀ ਸੀ ਔਫ਼ਿਸ ਵਿੱਚ ਇਹ ਤੁਸੀਂ ਮੋਹਾਲੀ ਇਸ ਟੈਮ ਰਹਿਨੇ ਹੋ ਨਾ ਜੀ ਮੋਹਾਲੀ ਸ਼ਿਫ਼ਟ ਕੀਤਾ ਜੀ ਤੁਸੀਂ ਹਾਂਜੀ ਹਾਂਜੀ ਹਾਂਜੀ ਇਹ ਨਾ ਸੱਤ ਫੇਜ਼ ਹੈ ਡੀ ਸੀ ਔਫ਼ਿਸ ਉੱਥੇ ਹੋਣਾ ਜੀ ਅਤੇ ਹਾਂਜੀ ਫਿਰ ਉਹਤੇ ਤੁਸੀਂ ਆਪਣੇ ਜੋ ਵੀ ਅਧਾਰ ਕਾਰਡ ਵਗੈਰਾ ਗੱਡੀ ਦੇ ਆਰ ਸੀ ਜਿਹੜੀ ਹੁੰਦੀ ਹੈ ਹੈ ਨਾ ਹੋਰ ਕਾਗਜ਼ ਪੱਤਰ ਲੈ ਕੇ ਕੱਲ੍ਹ ਨੂੰ ਦਸ ਵਜੇ ਉੱਥੇ ਪਹੁੰਚ ਜਿਓ ਜੀ ਤੁਸੀਂ ਹਾਂਜੀ ਅਤੇ ਬਾਕੀ ਜਿਹਨਾਂ ਨਾਲ਼ ਮਿਲਣਾ ਹੈ ਮੇਰੇ ਘਰ ਵਾਲੇ ਬਾਹਰ ਗਏ ਨੇ ਜੀ ਥੋੜ੍ਹਾ ਜਿਹਾ ਕੰਮ ਗਏ ਉਹਦੇ 'ਚ ਜਦੋਂ ਆ ਜਾਂਦੇ ਮੈਂ ਉਹਨਾਂ ਨਾਲ਼ ਮੈਂ ਫਿਰ ਗੱਲ਼ ਕਰਕੇ ਤੁਹਾਨੂੰ ਦੱਸ ਦੂਂਗੀ ਤੁਸੀਂ ਉਹਨਾ ਕਿੱਥੇ ਉਹਨਾਂ ਨੂੰ ਮਿਲਣਾ ਜਾ ਕੇ ਕਿਹਨੂੂੰ ਮਿਲਣਾ ਜੀ ਠੀਕ ਹੈ ਜੀ ਮੈਂ ਤੁਹਾਨੂੰ ਇੱਦਾਂ ਕਰੂਂਗੀ ਜੀ ਅੱਛਾ ਤੁਹਾਡਾ ਤੁਸੀਂ ਇਸੀ ਨੰਬਰ 'ਤੇ ਗੱਲ ਕਰਲੂਂਗੇ ਨਾ ਜੀ ਆਹ ਤੁਹਾਡਾ ਹੀ ਨੰਬਰ ਹੈ ਜੀ ਅੱਛਾ ਠੀਕ ਹੈ ਜੀ ਫ਼ਿਰ ਜਦੋਂ ਉਹ ਆ ਜਾਣਗੇ ਨਾ ਮੈਂ ਫ਼ਿਰ ਤੁਹਾਨੂੰ ਦੱਸ ਦੂਂਗੀ ਵੀ ਕਿਹਨੂੰ ਮਿਲਣਾ ਉੱਥੇ ਜਾ ਕੇ ਪਰ ਐਂ ਜੇ ਦਸ ਕੁ ਵਜੇ ਜੇ ਤੁਸੀਂ ਪਹੁੰਚ ਜਿਓ ਹੈ ਨਾ ਤੁਸੀਂ ਗੱਡੀ 'ਚ ਏ ਜਾਊਂਗੇ ਹੈ ਨਾ ਗੱਡੀ 'ਚ ਏ ਹਾਂ ਹਾਂਜੀ ਹਾਂਜੀ ਹਾਂਜੀ ਫਿਰ ਮੈਂ ਤੁਹਾਨੂੰ ਦੱਸ ਦੂਂਗੀ ਜੀ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ